ਮੈਂ ਮੋਹਾਲੀ ਜ਼ਿਲ੍ਹੇ ਦੇ ਕੁਰਾਲੀ ਦੀ ਰਹਿਣ ਵਾਲੀ ਹਾਂ ਜਿਸ ਤਰ੍ਹਾਂ ਕਿ ਮੈਂ ਦੱਸਣਾ ਚਾਹੁੰਦੀ ਹਾਂ ਕਿ ਜਿਹੜਾ ਕੁਰਾਲੀ ਵਿੱਚ ਕੋਈ ਵੀ ਕੁਦਰਤੀ ਸਰੋਤਰ ਮ ਨਹੀਂ ਹੈ ਅਤੇ ਜਿਹੜੇ ਜ਼ਿਲ੍ਹੇ ਦਾ ਪਾਣੀ ਦਾ ਸਰੋਤਰ ਹੈ ਸਾਡੇ ਜਿਵੇਂ ਕਿ ਅਸੀਂ ਦੇਖਿਆ ਸਰਕਾਰੀ ਜਿਹੜੇ ਹੈਗੇ ਆ ਪਾਣੀ ਅਸੀਂ ਵਰਤੋਂ ਕਰਦੇ ਨੇ ਸਰਕਾਰੀ ਪਾਣੀ ਵੀ ਬੜੀ ਉਹਦੇ ਵਿੱਚ ਕਈ ਅੱਜ ਕੱਲ੍ਹ ਜਿਸ ਤਰ੍ਹਾਂ ਪਿੱਛੇ ਜਿਹੇ ਬਹੁਤ ਬਾੜ ਆਈ ਹੈ ਬਾੜ ਦੇ ਕਾਰਨ ਜਿਹੜਾ ਪਾਣੀ ਵੀ ਬਹੁਤ ਖ਼ਰਾਬ ਜਿਹੜਾ ਹੈਗਾ ਹੋਇਆ ਉਹਦੇ ਨਾਲ਼ ਬਿਮਾਰੀਆਂ ਬੜੀਆਂ ਪੈਦਾ ਹੋਈਆਂ ਨੇ ਕਈ ਘਰਾਂ ਦੇ ਵਿੱਚ ਪਾਣੀ ਵੜਿਆ ਅਤੇ ਬਹੁਤ ਨੁਕਸਾਨ ਹੋਇਆ ਹੈ ਘਰਾਂ ਦਾ ਅਤੇ ਇਹਦੇ ਨਾਲ਼ ਜਿਹੜਾ ਹੈਗਾ ਬਹੁਤ ਜ਼ਿਆਦਾ ਨੁਕਸਾਨ ਹੋਣ ਨਾਲ ਜਿਹੜਾ ਹੈਗਾ ਹਰ ਇੱਕ ਇਨਸਾਨ ਇੰਨਾ ਉਲਝ ਚੁੱਕਿਆ ਸੀਗਾ ਪੰਦਰ੍ਹਾਂ ਪੰਦਰ੍ਹਾਂ ਵੀਹ ਵੀਹ ਦਿਨ ਉਹ ਪਾਣੀ ਵਿੱਚ ਰਿਹਾ ਅਤੇ ਬਾਕੀ ਜਿਹੜੇ ਕੂੜੇ ਦੀ ਗੱਲ ਕੀਤੀ ਜਾਵੇ ਤਾਂ ਕੂੜੇ ਦੇ ਢੇਰ ਇੰਨੇ ਲੱਗ ਚੁੱਕੇ ਸੀ ਕਿ ਉਹਨਾਂ ਨੂੰ ਸੰਭਾਲਣ ਦੀ ਵੀ ਮੁਸ਼ਕਿਲ ਆ ਰਹੀ ਸੀ ਵਰਕਰ ਜਿਹੜੇ ਹੈਗੇ ਸਾਨੂੰ ਮਿਲ ਨਹੀਂ ਰਹੇ ਸੀ ਅਸੀਂ ਆਪਣੇ ਨਿੱਜੀ ਪੱਧਰ 'ਤੇ ਜਿਹੜੇ ਹੈਗੇ ਐਫਰਟ ਕਰਕੇ ਇਹਨਾਂ ਨੂੰ ਕੂੜੇ ਦੇ ਢੇਰਾਂ ਨੂੰ ਚੁਕਵਾਇਆ ਗਿਆ